ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਮ ਤੁਸੀਂ ਜੇ ਐਂਡ ਯੂ ਲਾਈਬ੍ਰੇਰੀ ਚੋਂ ਬੋਲਦੇ ਪਏ ਜੀ ਠੀਕ ਹੈ ਜੀ ਮੈਮ ਮੈਂ ਥੋੜ੍ਹੀ ਨਾ ਇਨਫੋਰਮੇਸ਼ਨ ਲੈਣੀ ਸੀ ਐਕਚੁਲੀ ਮੈਂ ਕਾਫੀ ਦਿਨਾਂ ਤੋਂ ਨਾ ਤੁਹਾਡੀ ਲਾਈਬ੍ਰੇਰੀ 'ਚ ਆ ਰਹੀ ਹਾਂ ਐਜ਼ ਏ ਰੀਡਰ ਮੈਂ ਆ ਰਹੀ ਹਾਂ ਅਤੇ ਮੈਂ ਮਤਲਬ ਓ ਤੁਹਾਡੀ ਲਾਈਬ੍ਰੇਰੀ ਦੀ ਸਰਵਰਿਸ ਸਰਵਿਸਿਜ਼ ਕੀ ਹੈਗੀਆਂ ਨੇ ਕੀ ਰੀਸੋਰਸਿਸ ਹੈਗੇ ਨੇ ਉਹਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੀ ਹਾਂ

ਹਾਂਜੀ ਪੰਜਾਬੀ ਬਾਰੇ ਹੀ ਠੀਕ ਹੈ ਜੀ ਅੱਛਾ ਮੈਮ ਤੁਹਾਡੀ ਔਨਲਾਈਨ ਜਿਵੇਂ ਬੁਕਿੰਗ ਅਸੀਂ ਓ ਕਰ ਸਕਦੇ ਹਾਂ ਇਸ਼ੂ ਕਰਾ ਸਕਦੇ ਹਾਂ ਠੀਕ ਹੈ ਜੀ ਐਕਚੁਲੀ ਨਾ ਮੈਂ ਪਹਿਲਾਂ ਕੋਈ ਲਾਈਬ੍ਰੇਰੀ ਜੋਇਨ ਕੀਤੀ ਹੋਈ ਸੀ ਅਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਸਾਡੀ ਔਨਲਾਈਨ ਸਰਵਿਸ ਵੀ ਹੈਗੀ ਆ ਹੋਰ ਰੀਸੋਰਸ ਬਾਰੇ ਵੀ ਕਿਹਾ ਸੀ ਪਰ ਜਦੋਂ ਮੈਂ ਉੱਥੇ ਗਈ ਮੈਨੂੰ ਉਹ ਜਿਹੀ ਕੋਈ ਫੈਸਿਲਿਟੀ ਉੱਥੇ ਨਹੀਂ ਮਿਲੀ ਇਸ ਲਈ ਮੈਂ ਹੁਣ ਉਹ ਲਾਈਬ੍ਰੇਰੀ ਤਾਂ ਛੱਡ ਦਿੱਤੀ ਆ ਅਤੇ ਇਸ ਲਈ ਮੈਂ ਤੁਹਾਡੀ ਜੋਇਨ ਕਰਨ ਤੋਂ ਪਹਿਲਾਂ ਨਾ ਤਾਂ ਮੈਂ ਥੋੜ੍ਹੀ ਇਨਫੋਰਮੇਸ਼ਨ ਲੈਣਾ ਚਾਹੁੰਦੀ ਸੀ ਇਸ ਬਾਰੇ ਕੀ ਸ਼ੋਰ ਸ਼ੋਅਰ ਹੋਣਾ ਚਾਹੁੰਦੀ ਥੋੜ੍ਹੀ ਠੀਕ ਹੈ